ਉਦਯੋਗ ਉਦਯੋਗ ਦੀ ਗੱਲ ਕਰੀਏ ਤਾਂ ਸਾਡੇ ਏਰੀਏ ਵਿੱਚ ਜਿਹੜਾ ਹੈਗਾ ਮੇਨ ਪਟਾਕਾ ਫੈਕਟਰੀ ਹੋਈ ਸਾਬਣ ਫੈਕਟਰੀ ਹੋਈ ਇਹ ਮ ਮੇਨ ਜਿਹੜੀਆਂ ਹੈਗੇ ਕਾਰੋਬਾਰ ਉਦਯੋਗ ਹੈਗੇ ਹੈ ਜਿਨ੍ਹਾਂ ਨਾਲ ਜਿਹੜਾ ਹੈਗਾ ਇਸ ਕਾਰੋਬਾਰ ਨਾਲ ਬੜੇ ਵਿਕਾਸ ਵੀ ਹੋਇਆ ਜਿਸ ਤਰ੍ਹਾਂ ਕਿ ਮੰਨ ਕੇ ਚੱਲੋ ਤਾਂ ਕਾਫੀ ਜਿਹੜੇ ਹੈਗੇ ਆ ਆਪਣੇ ਆਮ ਜਿਹੜੀ ਜਨਤਾ ਹੈਗੀ ਹੈ ਉਹਨਾਂ ਨੂੰ ਕਈ ਰੁਜ਼ਗਾਰ ਦਾ ਸਾਧਨ ਵੀ ਖੁੱਲ੍ਹਿਆ ਰੁਜ਼ਗਾਰ ਮਿਲਿਆ ਕਈ ਜਿਹੜੇ ਹੈਗੇ ਬੇ ਬੇਰੁਜ਼ਗਾਰਾਂ ਨੂੰ ਜਿਹੜਾ ਆਮਦਨ ਦਾ ਸਾਧਨ ਹੋਣ ਕਰਕੇ ਜਿਹੜਾ ਹੈ ਉਹਨਾਂ ਦੇ ਘਰ ਗ੍ਰਸਤੀ ਜਿਹੜੀ ਹੈ ਚੰਗੀ ਚੱਲ ਸਕੀ ਜਿੱਥੋਂ ਤੱਕ ਹੋਏ ਆਪਾਂ ਉਹਨਾਂ ਦੀ ਚੁਣੌਤੀਆਂ ਦੀ ਗੱਲ ਕਰੀਏ ਤਾਂ ਚੁਣੌਤੀਆਂ ਵੀ ਬਹੁਤ ਸੀਗੀਆਂ ਹੁਣ ਪਿੱਛੇ ਜਿਹੇ ਸਾਡੇ ਵਾੜ ਆਈ ਵਾੜ ਦੇ ਵਿੱਚ ਕੀ ਹੋਇਆ ਕਿ ਇਹਨਾਂ ਨੇ ਫੈਕਟਰੀਆਂ ਨੇ ਜਿਹੜਾ ਆਪਣਾ ਕੈਮੀਕਲ ਵਾਲਾ ਪਾਣੀ ਸੀ ਉਹ ਇੰਝ ਹੀ ਛੱਡਿਆ ਵਾੜ ਵਿੱਚ ਛੱਡਤਾ ਜਿਹਦੇ ਨਾਲ ਘਰਾਂ ਦਾ ਨੁਕਸਾਨ ਹੋਇਆ ਵਾਤਾਵਰਨ ਦਾ ਇੰਨਾ ਨੁਕਸਾਨ ਹੋਇਆ ਕਿ ਜਿਹੜਾ ਹੈਗਾ ਬਿਮਾਰੀ ਬਹੁਤ ਪੈਦਾ ਹੋਣ ਦਾ ਖਤਰਾ ਬਣ ਗਿਆ ਔਰ ਮੌਕੇ ਮੌਕੇ ਤਾਂ ਇਹੀ ਹੈ ਜਿਸ ਤਰ੍ਹਾਂ ਕਿ ਮੈਂ ਪੈ ਪਹਿਲਾਂ ਵੀ ਦੱਸਿਆ ਕਿ ਮੌਕੇ ਇਹੀ ਦਿੱਤੇ ਗਏ ਹੈ ਕਿ ਜਿਹੜਾ ਰੁਜ਼ਗਾਰ ਮਿਲਿਆ ਔਰ ਕਾਫੀ ਜਿਹੜਾ ਹੈਗੇ ਆ ਗਰੀਬ ਤਬਕਾ ਹੈ ਇਹਨਾਂ ਨੂੰ ਜਿਹੜਾ ਬਹੁਤ ਆਸਾਨੀ ਨਾਲ ਆਪਣਾ ਘਰ ਚਲਾ ਸਕਣ